ਮੈਂ ਹੁਣ ਤੱਕ ਬਹੁਤ ਹੀ ਜ਼ਿਆਦਾ ਫ਼ੋਟੋਆਂ ਖਿੱਚੀਆਂ ਹਨ ਕਿਉਂਕਿ ਜਦੋਂ ਵੀ ਮੈਂ ਆਪਣੇ ਦੋਸਤ ਨੂੰ ਮਿਲਣ ਜਾਂਦਾ ਹਾਂ ਤਾਂ ਉਦੋਂ ਮੈਂ ਉਸ ਨਾਲ ਬਹੁਤ ਜ਼ਿਆਦਾ ਫ਼ੋਟੋਆਂ ਖਿੱਚਣੀਆਂ ਪਸੰਦ ਕਰਦਾ ਹਾਂ ਅਤੇ ਨਾਲ ਹੀ ਨਾਲ ਜਦੋਂ ਵੀ ਮੈਂ ਆਪਣੇ ਆਪਣੇ ਖੇਤਾਂ ਵਿੱਚ ਜਾਂਦਾ ਹਾਂ ਤਾਂ ਉਸ ਸਮੇਂ ਮੈਂ ਆਪਣੇ ਅ ਮਾਂ ਪਿਓ ਨਾਲ ਫ਼ੋਟੋਆਂ ਖਿੱਚਣਾ ਪਸੰਦ ਕਰਦਾ ਹਾਂ ਅਤੇ ਜਦੋਂ ਵੀ ਅਸੀਂ ਕੋਈ ਵੀ ਜਗ੍ਹਾ 'ਤੇ ਛੁੱਟੀਆਂ ਮਨਾਉਣ ਲਈ ਜਾਂਦੇ ਹਾਂ ਉੱਥੇ ਵੀ ਅਸੀਂ ਫ਼ੋਟੋਆਂ ਖਿੱਚਦੇ ਹਾਂ ਕਿਉਂਕਿ ਮੈਨੂੰ ਫ਼ੋਟੋਗ੍ਰਾਫ਼ੀ ਦਾ ਸ਼ੁਰੂ ਤੋਂ ਹੀ ਸ਼ੌਕ ਹੈ ਅਤੇ ਜਦੋਂ ਵੀ ਮੈਂ ਕਿਸੇ ਵੀ ਵਿਅਕਤੀ ਦੀ ਫੋਟੋ ਖਿੱਚਦਾ ਹਾਂ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹੁੰਦਾ ਹਾਂ